ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਮਾਧਵ ਟ੍ਰੈਵਲਰਸ ਨਾਲ ਹੋ ਰਹੀ ਹੈ ਮੈਂ ਆਪ ਜੀ ਦਾ ਧੰਨਵਾਦ ਕਰਨ ਲਈ ਫ਼ੋਨ ਕੀਤਾ ਹੈ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਰਾਤ ਮੈਂ ਤੁਹਾਡੀ ਕੈਬ ਵਿੱਚ ਸਫ਼ਰ ਕੀਤਾ ਜਿਸ ਦਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਤੁਹਾਡੇ ਡਰਾਈਵਰ ਦੀ ਗੱਲਬਾਤ ਬਹੁਤ ਚੰਗੀ ਸੀ ਉਨ੍ਹਾਂ ਨੇ ਮੈਨੂੰ ਬਹੁਤ ਹੀ ਸੁਰੱਖਿਅਤ ਢੰਗ ਦਾ ਮਹਿਸੂਸ ਕਰਵਾਇਆ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗ਼ਲਤ ਬਾਤ ਚੀਤ ਨਹੀਂ ਕੀਤੀ ਉਨ੍ਹਾਂ ਨੇ ਬੜੇ ਹੀ ਪਿਆਰ ਨਾਲ ਮੈਨੂੰ ਬੜੇ ਹੀ ਟਾਈਮ ਨਾਲ ਆਪਣੇ ਘਰ ਪਹੁੰਚਾ ਦਿੱਤਾ ਮੈਂ ਕੱਲ੍ਹ ਚੰਡੀਗੜ੍ਹ ਤੋਂ ਪਟਿਆਲੇ ਸਫ਼ਰ ਕਰ ਰਹੀ ਸੀ ਜਿਸ ਕਾਰਨ ਮੈਨੂੰ ਘਰ ਪਹੁੰਚਣ ਵਿੱਚ ਬਹੁਤ ਦੇਰ ਹੋ ਗਈ ਜਿਸ ਕਾਰਨ ਮੇਨੇ ਤੁਹਾਡੀ ਟੈਕਸੀ ਨੂੰ ਬੁੱਕ ਕੀਤਾ ਅਤੇ ਤੁਹਾਡੇ ਵੱਲੋਂ ਭੇਜਿਆ ਗਿਆ ਡਰਾਈਵਰ ਬਹੁਤ ਹੀ ਅੱਛੇ ਸੁਭਾਅ ਦਾ ਸੀ ਉਨ੍ਹਾਂ ਨੇ ਮੈਨੂੰ ਬਹੁਤ ਹੀ ਸੇਫ਼ ਢੰਗ ਨਾਲ ਘਰ ਪਹੁੰਚਾ ਦਿੱਤਾ ਤਾਂ ਜੋ ਮੇਰੇ ਮੰਮੀ ਪਾਪਾ ਨੂੰ ਵੀ ਇਸ ਗੱਲ ਨਾਲ ਬਹੁਤ ਅੱਛਾ ਮਹਿਸੂਸ ਹੋਇਆ ਕਿ ਮੈਂ ਸਮੇਂ ਤੋਂ ਪਹਿਲਾਂ ਹੀ ਘਰ ਪਹੁੰਚ ਗਈ ਮੈਂ ਇਹ ਫ਼ੋਨ ਤੁਹਾਨੂੰ ਧੰਨਵਾਦ ਕਰਨ ਲਈ ਕੀਤਾ ਹੈ ਕਿ ਧੰਨਵਾਦ ਤੁਹਾਨੇ ਇਸ ਅੱਛੀ ਸੁਵਿਧਾ ਦਾ ਮੈਨੂੰ ਲਾਭ ਉਠਾਉਣ ਦਾ ਮੌਕਾ ਦਿੱਤਾ ਇੱਕ ਵਾਰ ਮੈਂ ਤੁਹਾਡਾ ਫੇਰ ਧੰਨਵਾਦ ਕਰਨਾ ਚਾਹੁੰਦੀ ਹਾਂ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਗਰ ਮੈਨੂੰ ਤੁਹਾਡੀ ਦੁ ਲੋੜ ਦੁਬਾਰਾ ਪਈ ਤਾਂ ਮੈ ਤੁਹਾਨੂੰ ਕੋਂਨਟੈਕਟ ਕਰੁੰਗੀ ਧੰਨਵਾਦ